ਹੈਲੋ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੱਲ੍ਹ ਯਾਦ ਹੈ ਮੈਂ ਤਰਨਦੀਪ ਕੌਰ ਪੰਜ ਵਜੇ ਆਈ ਸੀ ਤੁਹਾਡੇ ਕੋਲ ਇੰਫਲੀਮੈਂਸ਼ਨ ਟੈਸਟ ਦੀ ਅਪੋਇੰਟਮੈਂਟ ਸੀਗੀ ਮੇਰੀ ਅਤੇ ਤੁਸੀਂ ਮੈਨੂੰ ਨਾ ਮੈਡੀਸਨ ਦਿੱਤੀਆਂ ਸੀਗੀਆਂ ਇੱਕ ਤਾਂ ਰੈੱਡ ਕਲਰ ਦੀ ਸੀ ਜਿਹੜੀ ਸਵੇਰੇ ਸ਼ਾਮ ਲੈਣੀ ਸੀ ਇੱਕ ਬਲੂ ਸੀਗੀ ਜਿਹੜੀ ਖਾਣੇ ਤੋਂ ਬਾਅਦ ਰਾਤ ਨੂੰ ਲੈਣੀ ਸੀਗੀ ਅਤੇ ਤੁਸੀਂ ਕਿਹਾ ਸੀ ਵੀ ਜੇ ਤਾਂ ਮਤਲਬ ਜ਼ਿਆਦਾ ਹੋਵੇ ਪ੍ਰੋਬਲਮ ਫਿਰ ਤੁਸੀਂ ਘੰਟੇ ਘੰਟੇ ਬਾਅਦ ਲੈਣੀ ਹੈ ਜੇ ਨਾ ਹੋਵੇ ਮਤਲਬ ਠੀਕ ਹੋ ਜੇ ਥੋੜ੍ਹਾ ਬੈਟਰ ਹੋ ਜੇ ਫਿਰ ਚਾਰ ਚਾਰ ਘੰਟੇ ਬਾਅਦ ਲੈ ਲਿਓ ਅਤੇ ਮੈਨੂੰ ਲੱਗਦਾ ਵੀ ਮੈਂ ਜਦ ਨਾ ਮਤਲਬ ਸਟਾਰਟਿੰਗ ਸਟਾਰਟਿੰਗ ਘੰਟੇ ਘੰਟੇ ਬਾਅਦ ਲੈ ਰਹੀ ਸੀਗੀ ਫਿਰ ਤਾਂ ਠੀਕ ਸੀਗਾ ਉਸ ਤੋਂ ਬਾਅਦ ਜਦੋਂ ਮੈਂ ਚਾਰ ਚਾਰ ਘੰਟੇ ਕਰਤਾ ਉਹ ਫਿਰ ਉਹੀ ਦੁਬਾਰਾ ਉਹੀ ਚੀਜ਼ ਹੋਣ ਲੱਗ ਗਈ ਡੋਜ਼ ਅਤੇ ਮਤਲਬ ਜਿਵੇਂ ਤੁਸੀਂ ਕਿਹਾ ਸੀ ਹਾਂ ਹਾਂ ਬਿਲਕੁਲ ਮੈਂ ਮੈਂ ਕੋਈ ਮਿਰਚ ਮਸਾਲੇ ਵਾਲਾ ਖਾਣਾ ਨਹੀਂ ਖਾ ਰਹੀ ਕੋਈ ਮਤਲਬ ਕਹਿ ਲਉ ਕਿ ਕੌਫ਼ੀ ਵਗੈਰਾ ਨਹੀਂ ਲੈ ਰਹੀ ਚਾਹ ਵੀ ਤੁਸੀਂ ਕਿਹਾ ਸੀ ਵੀ ਮੈਂ ਤਿੰਨ ਕੱਪ ਪੀਂਦੇ ਹੋ ਤਾਂ ਇੱਕ ਕਰਦੋ ਉਹ ਵੀ ਘੱਟ ਕਰਤਾ ਪਰ ਮਤਲਬ ਤਾਂ ਵੀ ਨਾ ਮਤਲਬ ਮੈਨੂੰ ਲੱਗਦਾ ਵੀ ਦਵਾਈ ਨਾਲ ਦਵਾਈ ਖਾਂਦੀ ਹਾਂ ਤਾਂ ਫ਼ਰਕ ਪੈ ਜਾਂਦਾ ਹੈ ਉਸ ਤੋਂ ਬਿਨਾਂ ਨੋਰਮਲੀ ਠੀਕ ਨਹੀਂ ਰਹਿੰਦੀ ਮਤਲਬ ਬਿਨਾਂ ਕੁਛ ਖਾਧੇ ਹੀ ਫਾਲਤੂ 'ਚ ਹੀ ਮਤਲਬ ਪੇਨ ਹੋਣਾ ਸ਼ੁਰੂ ਹੋ ਜਾਂਦਾ ਹਾਂਜੀ ਪਰ ਤੁਸੀਂ ਇੱਕ ਮੈਨੂੰ ਰੈਕਮੈਂਡ ਵੀ ਕਰਿਆ ਸੀ ਨਾ ਇੱਕ ਟੈਸਟ ਕਰਵਾਉਣ ਵਾਸਤੇ ਵੀ ਸ਼ਾਇਦ ਖਾਣ ਪੀਣ ਕਰਕੇ ਨਹੀਂ ਹੋਰਮੋਨਲ ਵੀ ਹੋ ਸਕਦੀ ਹੈ ਪ੍ਰੋਬਲਮ ਅਤੇ ਉਹ ਜਦ ਮੈਂ ਹਾਂਜੀ ਹਾਂਜੀ ਉਹ ਜਿਹੜਾ ਕਰਿਆ ਸੀ ਉਹਦੇ ਵਿੱਚ ਮਤਲਬ ਜਿਹੜਾ ਐੱਸ ਏ ਟੀ ਸੀਗਾ ਉਹਦੇ ਵਿੱਚ ਦਿੱਕਤ ਹੈਗੀ ਆ ਬਾਕੀ ਤਾਂ ਠੀਕ ਸੀ ਫਿਰ ਉਹ ਮੈਂ ਤੁਹਾਨੂੰ ਹੁਣ ਕਦੋਂ ਦਿਖਾਉਣ ਆਵਾਂ ਨਹੀਂ ਫਿਰ ਹੁਣ ਤਦ ਤੱਕ ਜਿਹੜੀ ਮੈਂ ਮੇਰੇ ਕੋਲ ਡੋਜ਼ ਪਈਆਂ ਜਿਹੜੀਆਂ ਦੋ ਤਿੰਨ ਉਹ ਮੈਂ ਘੰਟੇ ਘੰਟੇ ਬਾਅਦ ਰੱਖਾਂ ਕਿ ਫਿਰ ਚਾਰ ਚਾਰ ਘੰਟੇ ਬਾਅਦ ਹੀ ਕਰਾਂ ਘੰਟੇ ਘੰਟੇ ਬਾਅਦ ਠੀਕ ਹੈ ਚਲੋ ਥੈਂਕ ਥੈਂਕ ਯੂ ਸੋ ਮੱਚ